ਮੈਂ ਇੱਕ ਕੈਬ ਬੁੱਕ ਕੀਤੀ ਸੀ ਜੋ ਕਿ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਦੀ ਸੀ ਅਤੇ ਜੋ ਕਾ ਕੈਬ ਦਾ ਡਰਾਈਵਰ ਸੀ ਬਹੁਤ ਵਧੀਆ ਸੀ ਬਹੁਤ ਵਧੀਆ ਸੁਭਾਅ ਸੀ ਉਹਨਾਂ ਦਾ ਅਤੇ ਨਸ਼ਾ ਮੁਕਤ ਸੀ ਉਹਨਾਂ ਨੇ ਜਾਂ ਮੈਨੂੰ ਫਤਿਹਗੜ੍ਹ ਤੋਂ ਲੈ ਕੇ ਦਿੱਲੀ ਤੱਕ ਜੋ ਵੀ ਵਧੀਆ ਸਥਾਨ ਸੀ ਸਾਰੇ ਘੁੰਮਾਏ ਅਤੇ ਕੈ ਅਤੇ ਵਧੀਆ ਰਿਸਪਾਂਸ ਵੀ ਦਿੱਤਾ ਅਤੇ ਮੈਨੂੰ ਬਹੁਤ ਘੱਟ ਸਮੇਂ ਦੇ ਵਿੱਚ ਅਤੇ ਘੱਟ ਕਿਰਾਏ ਦੇ ਵਿੱਚ ਉਹਨਾਂ ਨੇ ਦਿੱਲੀ ਪਹੁੰਚਾਇਆ ਜਿਸ ਨਾਲ ਮੈਨੂੰ ਬਹੁਤ ਵਧੀਆ ਲੱਗਾ ਕਿ ਨਸ਼ਾ ਮੁਕਤ ਸੀ ਕੋਈ ਨਸ਼ਾ ਨਹੀਂ ਸੀ ਕਰਦੇ ਵਧੀਆ ਚਲਾ ਰਹੇ ਸੀ ਕੋਈ ਰੂਲ ਰੈਗੂਲੇਸ਼ਨ ਨਹੀਂ ਉਹਨਾਂ ਨੇ ਤੋੜਿਆ ਬਹੁਤ ਜ਼ਿਆਦਾ ਵਧੀਆ ਸੀ ਅਤੇ ਬਹੁਤ ਹੀ ਪਿਆਰ ਨਾਲ ਗੱਲਬਾਤ ਕਰਨ ਵਾਲੇ ਸੀ ਜਿਸ ਨਾਲ ਕਿ ਵਧੀਆ ਫੀਲ ਹੋਇਆ ਕਿ ਹਾਂਜੀ ਵਧੀਆ ਕੈਬ ਬੁੱਕ ਮੈਂ ਕੀਤੀ ਹੈ ਮੈਨੂੰ ਅੱਗੇ ਤੋਂ ਵੀ ਨਾ ਜਾਣ ਵੇਲੇ ਇਹ ਝਿਜਕ ਨਹੀਂ ਹੋਏਗੀ ਕਿ ਹਾਂ ਕੈਬ ਵਿੱਚ ਕੋਈ ਦਿੱਕਤ ਆ ਸਕਦੀ ਹੈ ਅਤੇ ਸਾਨੂੰ ਇੱਕ ਵਾਰ ਦਿੱਕਤ ਆਈ ਬਟ ਉਹਨਾਂ ਨੇ ਉਹ ਵੀ ਬਹੁਤ ਵਧੀਆ ਅਤੇ ਬਹੁਤ ਵਧੀਆ ਢੰਗ ਨਾਲ ਸੋਲਵ ਕੀਤੀ ਜਿਸ ਨਾਲ ਕਿ ਮੈਂ ਫਤਿਹਗੜ੍ਹ ਤੋਂ ਦਿੱਲੀ ਅਰਾਮ ਨਾਲ ਚਲੀ ਗਈ ਅਤੇ ਮੈਨੂੰ ਥੋੜ੍ਹੇ ਹੀ ਟੈਮ ਵਿੱਚ ਪਹੁੰਚਾ ਕੇ ਗਏ ਜਿਸ ਨਾਲ ਮੈਨੂੰ ਬਹੁਤ ਜ਼ਿਆਦਾ ਵਧੀਆ ਫੀਲ ਹੋਈ ਵੀ ਹਾਂ ਅਰਾਮ ਨਾਲ ਪਹੁੰਚੇ ਅਤੇ ਕੋਈ ਵੀ ਟੈਨਸ਼ਨ ਫਰੀ ਹੋ ਕੇ ਅਤੇ ਬਹੁਤ ਵਧੀਆ ਫੀਲਿੰਗ ਆਈ ਮਤਲਬ ਇੱਕ ਤਰ੍ਹਾਂ ਨਾਲ ਬੀ ਘਰ ਵਾਲੇ ਫੈਮਲੀ ਵਾਂਗ ਉਹਨਾਂ ਨੇ ਟ੍ਰੀਟ ਕੀਤਾ ਕਿ ਇਹ ਨਹੀਂ ਸੀ ਵੀ ਹਾਂ ਚਲੋ ਨਹੀਂ ਐਵੇਂ ਨਹੀਂ ਐਵੇਂ ਤਾਂ ਬਹੁਤ ਵਧੀਆ ਲੱਗਾ ਕਿ ਕੈਬ ਵਾਲੇ ਵੀ ਕਈ ਬਹੁਤ ਚੰਗੇ ਹੁੰਦੇ ਨੇ ਜੋ ਕਿ ਵਧੀਆ ਢੰਗ ਨਾਲ ਅਤੇ ਵਧੀਆ ਤੁਹਾਨੂੰ ਟਾਈਮ ਸਿਰ ਪਹੁੰਚਾਉਂਦੇ ਨੇ ਉਹਨਾਂ ਨੇ ਨਸ਼ਾ ਕੋਈ ਨਹੀਂ ਸੀ ਕੀਤਾ ਹੋਇਆ ਬਹੁਤ ਹੀ ਧਿਆਨ ਨਾਲ ਗੱਡੀ ਚਲਾ ਰਹੇ ਸੀ